ਮੈਂ ਰੋਪੜ ਸ਼ਹਿਰ ਵਿੱਚ ਰਹਿੰਦੀ ਹਾਂ ਜਿੱਥੇ ਪਹਿ ਪਹਿਲਾਂ ਦੇ ਸਮੇਂ ਵਿੱਚ ਹੜੱਪਾ ਸੱਭਿਅਤਾ ਦਾ ਦਾ ਬਹੁਤ ਵੱਡਾ ਯੋਗਦਾਨ ਸੀ ਪਹਿਲਾਂ ਦੇ ਟਾਇਮ ਦੇ ਵਿੱਚ ਜਿਹੜੀਆਂ ਕਲਾ ਕ੍ਰਿਤੀਆਂ ਹੁੰਦੀਆਂ ਸਨ ਉਹ ਸਾਰੀਆਂ ਸਾਨੂੰ ਸਾਡੇ ਇੱਥੇ ਤੋਂ ਇੱਥੇ ਦੀ ਜ਼ਮੀਨ ਤੋਂ ਪ੍ਰਾਪਤ ਹੋਈਆਂ ਅਤੇ ਉਸ ਤੋਂ ਬਾਅਦ ਉਹ ਸਾਰੀਆਂ ਜਿੰਨੇ ਵੀ ਸਾਨੂੰ ਚਿੰਨ੍ਹ ਪ੍ਰਾਪਤ ਹੋਏ ਸਨ ਫਿਰ ਉਹਨਾਂ ਨੂੰ ਸਾਡੇ ਇੱਥੇ ਦੇ ਰੋਪੜ ਮਿਊਜ਼ੀਅਮ ਵਿੱਚ ਰੱਖਿਆ ਗਿਆ ਜਿਹਦੇ ਕਰਕੇ ਸਾਡਾ ਰੋਪੜ ਮਿਊਜ਼ੀਅਮ ਬਹੁਤ ਹੀ ਜ਼ਿਆਦਾ ਮਸ਼ਹੂਰ ਹੋਇਆ ਉਸ ਤੋਂ ਬਾਅਦ ਇਹ ਜੋ ਸੱਭਿਅਤਾ ਹੈ ਇਸ ਦਾ ਸਾਡੇ ਵਿਰਾਸਤ ਵਿੱਚ ਬਹੁਤ ਵੱਡਾ ਯੋਗਦਾਨ ਹੈ